ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਇਸਲਾਮਾਬਾਦ ਮੁਹੱਲੇ ਤੋਂ ਬੋਲਦੀ ਪਈ ਹਾਂ ਮੇਰਾ ਨਾਮ ਹੈ ਪਿੰਕੀ ਅਸੀਂ ਨਾ ਇੱਧਰ ਨਵੇਂ ਆਏ ਹਾਂ ਅਤੇ ਇੱਥੇ ਦੁੱਧ ਵਾਲੀ ਡੇਅਰੀ ਕੋਈ ਹੈ ਚੰਗੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਵੈਸੇ ਨਵੇਂ ਆਏ ਸਾਨੂੰ ਪਤਾ ਨਹੀਂ ਨਾ ਇੱਥੇ ਕੋਈ ਡੇਅਰੀ ਹੈ ਹਾਂਜੀ

ਹਾਂਜੀ ਠੀਕ ਹੈ ਜੀ ਧੰਨਵਾਦ ਆਂਟੀ ਧੰਨਵਾਦ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ